ਭਾਸ਼ਾ ਕਿਸੇ ਵੀ ਭੂਗੋਲਿਕ ਖਿੱਤ ਖਿੱਤੇ ਦੇ ਪੁਖਤਾ ਸਮਾਜ 'ਤੇ ਸੰਚਾਰ ਦਾ ਸਾਧਨ ਹੁੰਦੀ ਹੈ ਅਤੇ ਉੱਥੋਂ ਦੇ ਲੋਕਾਂ ਦਾ ਸਮਾਜਿਕ ਮਿਲ ਵਰਤੋਂ ਨੂੰ ਪ੍ਰਵਾਨ ਚੜ੍ਹਾਉਂਦੀ ਹੈ ਇਹ ਮੰਨਿਆ ਜਾਂਦਾ ਹੈ ਕਿ ਭਾਸ਼ਾ ਮਨੁੱਖ ਦੇ ਕੁਛ ਖਾਸ ਅੰਗਾਂ ਦੇ ਦੇ ਵਿਕਾਸ ਦੌਰਾਨ ਹੀ ਮਨੁੱਖੀ ਵਿਕਾਸ ਦੇ ਇੱਕ ਪੜਾਅ 'ਤੇ ਵਿਕਸਿਤ ਹੋਈ ਹੈ ਜਿਸੀ ਤਰ੍ਹਾਂ ਉਹ ਹੋਰਾਂ ਜਗ੍ਹਾ ਫੈਲਦੇ ਗਏ ਅਤੇ ਹੋਰ ਕਬੀਲਿਆਂ ਜਾਤੀਆਂ ਦੇ ਸਮਾਜ ਨਾਲ ਮਿਲ ਵਰਤੋਂ ਵਧਾਉਂਦੇ ਗਏ ਦੂਜੀਆਂ ਭਾਸ਼ਾਵਾਂ ਤੋਂ ਸ਼ਬਦ ਉਧਾਰ ਲੈ ਕੇ ਇੱਕ ਇਲਾਕੇ ਜਾਂ ਪ੍ਰਦੇਸ਼ ਦੀ ਭਾਸ਼ਾ ਹੋਂਦ ਵਿੱਚ ਆਉਂਦੀ ਗਈ ਸਾਰੀ ਭਾਸ਼ਾਵਾਂ ਤਕਰੀਬਨ ਕਿਸੇ ਇਸ ਤਰ੍ਹਾਂ ਹੀ ਵਿਕਸਿਤ ਹੋਈ ਹੈ